ਮੈਨੂੰ ਬਾਈਕ ਦਾ ਬਹੁਤ ਹੀ ਸ਼ੌਕ ਹੈ ਅਤੇ ਮੇਰੇ ਕੁਝ ਮਨਪਸੰਦ ਬਾਈਕ ਦੇ ਵਿੱਚੋਂ ਇੱਕ ਤਾਂ ਬੁਲਟ ਹੈ ਜੋ ਕਿ ਰੋਇਲ ਇਨਫੀਲਡ ਦਾ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਅਤੇ ਕਈ ਇੱਕ ਮੈਨੂੰ ਅਵੈਂਜਰ ਰੇਸਰ ਬਾਈਕ ਵੀ ਬਹੁਤ ਹੀ ਜ਼ਿਆਦਾ ਪਸੰਦ ਹੈ ਮੇਰੇ ਕੋਲ ਇਸ ਟਾਈਮ 'ਤੇ ਰੋਇਲ ਇਨਫਿਲਡ ਦਾ ਬੁਲਟ ਹੈ ਜੋ ਕਿ ਕਾਲੇ ਰੰਗ ਦਾ ਹੈ ਅਤੇ ਉਹ ਵੀ ਚਲਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਸਮੂਦ ਅਤੇ ਆਰਾਮਦਾਇਕ ਹੈ ਮੇਰਾ ਡਰੀਮ ਬਾਈਕ ਹਾਰਲੇ ਡੈਵਿਡਸਨ ਹੈ ਜੋ ਕਿ ਦਿਖਣ ਦੇ ਵਿੱਚ ਬਹੁਤ ਹੀ ਸੋਹਣਾ ਹੈ ਅਤੇ ਉਹਨੂੰ ਕਿਸੇ ਵੀ ਮੁਸ਼ਕਲ ਤਰ੍ਹਾਂ ਦੇ ਰਸਤੇ ਦੇ ਵਿੱਚ ਚਲਾਉਣਾ ਬਹੁਤ ਜ਼ਿਆਦਾ ਆਸਾਨੀ ਨਾਲ ਬੰਦਾ ਮੁਸ਼ਕਲ ਰਸਤੇ ਦੇ ਵਿੱਚੋਂ ਨਿਕਲ ਸਕਦਾ ਹੈ ਅਤੇ ਉਹਦਾ ਜੋ ਵੀ ਸਾਰਾ ਉਹਦਾ ਸਟਕਚਰ ਹੁੰਦਾ ਹੈ ਬਹੁਤ ਹੀ ਜ਼ਿਆਦਾ ਮਜ਼ਬੂਤ ਹੁੰਦਾ ਹੈ ਕਿ ਉਹਦਾ ਜਿੰਨਾ ਵੀ ਉਹਦਾ ਸਮਾਂ ਹੁੰਦਾ ਉਹਦਾ ਚੱਲਣ ਦਾ ਬੰਦਾ ਉਹਦੇ ਨਾਲ ਆਸਾਨੀ ਨਾਲ ਚਲਾ ਸਕਦਾ ਕਿ ਉਹਦੇ ਵਿੱਚ ਖਰਾਬੀਆਂ ਬਹੁਤ ਹੀ ਜ਼ਿਆਦਾ ਘੱਟ ਹੁੰਦੀਆਂ ਹਨ ਮੇਰੀ ਜੋ ਡਰੀਮ ਬਾਈਕ ਹੈ ਹਾਰਲੇ ਡੈਵਿਡਸਨ ਮੈਂ ਚਾਹੁੰਦੀ ਹਾਂ ਕਿ ਜਦੋਂ ਵੀ ਮੈਂ ਚੰਗੀ ਨੌਕਰੀ 'ਤੇ ਲੱਗਾ ਤਾਂ ਮੈਂ ਸਭ ਤੋਂ ਪਹਿਲਾਂ ਉਸ ਨੂੰ ਹੀ ਖਰੀਦਾਂ ਕਿਉਂਕਿ ਉਹਦਾ ਜੋ ਆਰਾਮਦਾਇਕ ਉਹਦਾ ਜੋ ਇੱਕ ਫੀਚਰ ਆ ਉਹ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਉਸ ਬੁੱਲ ਬਾਈਕ ਨੂੰ ਮੈਂ ਆਪਣਾ ਇੱਕ ਵਾਰ ਜ਼ਿੰਦਗੀ ਦੇ ਵਿੱਚ ਜ਼ਰੂਰ ਚਲਾਵਾਂ ਕਿਉਂਕਿ ਉਹਨੂੰ ਚਲਾ ਕੇ ਮੈਨੂੰ ਹਰ ਤਰ੍ਹਾਂ ਦਾ ਜੋ ਇੱਕ ਆਸਾਨੀ ਦੇ ਨਾਲ ਚਲਾਉਣ ਵਾਲੀ ਬਾਈਕ ਦਾ ਹਰ ਫੀਚਰ ਮੈਨੂੰ ਪਤਾ ਲੱਗ ਜਾਵੇਗਾ ਅਤੇ ਇਸ ਤਰ੍ਹਾਂ ਮੈਂ ਆਪਣੀ ਬਾਈਕ ਦੇ ਬਾਰੇ ਸੋਚਦੀ ਹਾਂ ਅਤੇ ਫਿਊਚਰ ਦੇ ਵਿੱਚ ਮੈਂ ਲੈਣਾ ਚਾਹੁੰਦੀ ਹਾਂ